ਬਾਈਕਿੰਗ ਨੂੰ ਲੋਕਾਂ ਦੇ ਜਨੂੰਨ ਵਜੋਂ ਅਸੀਂ ਕੁਝ ਇਸ ਤਰ੍ਹਾਂ ਦੇਖਦੇ ਹਾਂ ਜਿਵੇਂ ਕਿ ਅੱਜ ਕੱਲ੍ਹ ਛੋਟੀ ਉਮਰ ਵਿੱਚ ਹੀ ਨੌਜਵਾਨ ਬਾਈਕ ਸਿੱਖਣ ਲੱਗ ਜਾਂਦੇ ਨੇ ਅਤੇ ਉਹ ਬਾਈਕ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੁੰਦੇ ਨੇ ਪਰ ਸਭ ਤੋਂ ਵੱਡੀ ਇਹ ਗੱਲ ਆ ਕਿ ਚਲੋ ਆਪਾਂ ਲੋਕਲ ਤਾਂ ਬਾਈਕ ਚਲਾ ਸਕਦੇ ਹਾਂ ਪਰ ਏਟੀਨ ਅਬੱਵ ਅਠਾਰ੍ਹਾਂ ਪਲੱਸ ਤੋਂ ਬਾਅਦ ਹੀ ਉਹਨਾਂ ਦਾ ਲਾਇਸੈਂਸ ਬਣਦਾ ਅਤੇ ਉਹ ਬਾਈਕ ਚਲਾਉਣ ਲਈ ਦੇ ਯੋਗ ਹੋ ਜਾਂਦੇ ਨੇ ਅਤੇ ਕੁਝ ਲੋਕ ਬਾਈਕਿੰਗ ਕਰਦੇ ਸਮੇਂ ਬਹੁਤ ਹੀ ਗੱਲਾਂ ਦਾ ਧਿਆਨ ਰੱਖਦੇ ਨੇ ਜਿਵੇਂ ਹੈਲਮਟ ਸੀਟ ਬੈਲਟ ਬਾਹਾਂ 'ਤੇ ਕੱਪ ਅਜਿਹੀਆਂ ਚੀਜ਼ਾਂ ਦਾ ਅਤੇ ਕੁਝ ਬਹੁਤ ਹੀ ਲਾਪਰਵਾਹੀ ਕਰਦੇ ਨੇ ਤੇਜ਼ ਭਜਾਉਂਦੇ ਨੇ ਰੇਸਾਂ ਲਾਉਂਦੇ ਨੇ ਜੋ ਕਿ ਦੁਰਘਟਨਾ ਦਾ ਹਿੱਸਾ ਬਣਦੇ ਨੇ ਨੌਜਵਾਨਾਂ ਨੂੰ ਕਈ ਨੌਜਵਾਨ ਬਾਈਕਾਂ ਬਾਈਕ ਕਮਿਊਨਟੀ ਵਿੱਚ ਵੀ ਸ਼ਾਮਿਲ ਹੁੰਦੇ ਨੇ ਹਿੱਸਾ ਲੈਂਦੇ ਨੇ ਅਜਿਹੀਆਂ ਹੋਰ ਵੀ ਬਹੁਤ ਗੱਲਾਂ ਨੇ ਜਿਵੇਂ ਉਹ